ਅਸੀਂ ਮੈਂ ਜਿਸ ਕੱਪੜੇ ਨੂੰ ਬਣਾਉਣਾ ਚਾਹੁੰਦੀ ਹਾਂ ਉਸ ਦਾ ਡਿਜ਼ਾਇਨ ਜਾਂ ਪੈਟਰਨ ਮੈਂ ਆਪਣੇ ਕਿਸੇ ਫਰੈਂਡ ਆਪਣੇ ਕਿਸੇ ਦੋਸਤ ਜਾਂ ਆਪਣੀ ਮਾਤਾ ਜੀ ਤੋਂ ਸਿੱਖਦੀ ਹਾਂ ਇਸ ਦੇ ਨਾਲ ਹੀ ਮੈਂ ਜੋ ਵੀ ਬਣਾਉਣਾ ਚਾਹੁੰਦੀ ਹਾਂ ਉਸ ਦੇ ਲਈ ਆਨਲਾਈਨ ਸਰਚ ਕਰਕੇ ਮੈਂ ਉਸ ਬਾਰੇ ਪੂਰੀ ਨੌਲੇਜ ਪ੍ਰਾਪਤ ਕਰ ਲੈਂਦੀ ਹਾਂ ਅਤੇ ਫਿਰ ਮੈਂ ਆਪਣੇ ਅਕੋਰਡਿੰਗ ਉਸ ਨੂੰ ਬਣਾਉਂਦੀ ਹਾਂ ਇਸ ਲਈ ਮੇਰੇ ਕੋਲ ਮੇਰੇ ਕੋਲ ਪ੍ਰੇਰਨਾ ਲਈ ਆਨਲਾਈਨ ਸਰੋਤ ਹਨ ਅਤੇ ਮੇਰੇ ਮਾਤਾ ਜੀ ਵੀ ਮੈਨੂੰ ਬਹੁਤ ਸਾਰਾ ਸਪੋਰਟ ਕਰਦੇ ਹਨ ਕੱਪੜਾ ਬਣਾਉਣ ਦੇ ਵਿੱਚ